ਥਰੈਸ਼ਹੋਲਡਰ ਇਹ ਨਾ ਪੁਰਾਣੇ ਜ਼ਮਾਨੇ ਵਿੱਚ ਹੁੰਦਾ ਸੀ ਹੁਣ ਤਾਂ ਲੋਕ ਇਹਨੂੰ ਭੁੱਲ ਗਏ ਹੈ ਇਹ ਸਾਰੇ ਪਾਣੀ ਵਿੱਚ ਗੋਬਰ ਨੂੰ ਮਿਲਾ ਕੇ ਸਾਰੇ ਘਰ ਨੂੰ ਬਹੁਤ ਵਧੀਆ ਨਾਲ ਸਫਾਈ ਪੋਚਾ ਮਾਰਦੇ ਸੀ ਮਤਲਬ ਉਹ ਬਹੁਤ ਸ਼ੁੱਧੀ ਹੋ ਜਾਂਦੀ ਸੀ ਘਰ ਦੀ ਅਤੇ ਬੱਚਿਆਂ ਨੂੰ ਵੀ ਕਹਿੰਦੇ ਸੀ ਵੀ ਨਜ਼ਰ ਦੂਸਰਿਆਂ ਦੀ ਕੋਈ ਬੁਰੀ ਚੀਜ਼ ਘਰ ਵਿੱਚ ਨਹੀਂ ਆਉਂਦੀ ਹੁਣ ਤਾਂ ਲੋਕ ਫਿਨਾਇਲ ਵਗੈਰਾ ਯੂਜ਼ ਕਰਨ ਲੱਗ ਪਏ ਉਹ ਪਹਿਲਾਂ ਦੇ ਹੁੰਦੇ ਸੀ ਹੁਣ ਤਾਂ ਇਹ ਲੋਕ ਯੂਜ਼ ਨਹੀਂ ਕਰਦੇ ਕਈ ਲੋਕ ਕਰਦੇ ਹਾਂ ਜਿੱਦਾਂ ਕਿ ਉਪਲੇ ਵਗੈਰਾ ਬਣਾ ਕੇ ਚੁੱਲ੍ਹੇ 'ਤੇ ਮਤਲਬ ਲਾ ਕੇ ਫਿਰ ਖਾਣਾ ਵੀ ਬਣਾਉਂਦੇ ਹੈ ਹਾਂਜੀ ਅਤੇ ਉਹ ਬਹੁਤ ਮਤਲਬ ਬੈਨੀਫਿੱਟ ਉਹਦਾ ਬਹੁਤ ਹੈ ਜੇ ਚੁੱਲ੍ਹੇ 'ਤੇ ਖਾਣਾ ਬਣਾ ਕੇ ਹੈ ਨਾ ਔਰ